ਹਾਂਜੀ ਮੋਹਾਲੀ ਦੇ ਨੇੜੇ ਕਈ ਖਾਸ ਖੇਤਰ ਹਨ ਜੋ ਕਿ ਆਪਣੀ ਸੁੰਦਰਤਾ ਲਈ ਬਹੁਤ ਮਸ਼ਹੂਰ ਹਨ ਜਿਵੇਂ ਕਿ ਹਿਮਾਚਲ ਅਤੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਜਿਵੇਂ ਕਿ ਰੋਜ਼ ਗਾਰਡਨ ਹੈ ਰੌਕ ਗਾਰਡਨ ਹੈ ਸੁਖਨਾ ਲੇਕ ਹੈ ਜਿੱਥੇ ਕਿ ਬਹੁਤ ਦੂਰੋਂ ਦੂਰੋਂ ਵਸਨੀਕ ਘੁੰਮਣ ਆਉਂਦੇ ਹਨ ਅਤੇ ਸ਼ੋਪਿੰਗ ਕਰਦੇ ਹਨ ਇੱਥੇ ਬਹੁਤ ਸਾਰੇ ਪਾਰਕਾਂ ਹਨ ਜਿੱਥੇ ਕਿ ਲੋਕ ਆਨੰਦ ਬਹਿ ਕੇ ਆਨੰਦ ਮਾਣਦੇ ਹਨ ਇੱਥੇ ਉੱਨੀ ਦੀ ਮਾਰਕਿਟ ਵਿੱਚ ਫੁਹਾਰੇ ਲੱਗੇ ਹੋਏ ਹਨ ਜਿਸ ਵਿੱਚ ਰਾਤ ਨੂੰ ਲਾਈਟਾਂ ਬਲਦੀਆਂ ਹਨ ਜੇ ਮੈਂ ਹਿਮਾਚਲ ਦੀ ਗੱਲ ਕਰਾਂ ਜਿਵੇਂ ਹਿਮਾਚਲ ਜਿਵੇਂ ਕਿ ਹਿਮਾਚਲ ਦੇ ਵਿੱਚ ਕੁੱਲੂ ਮਨਾਲੀ ਸ਼ਿਮਲਾ ਜਿੱਥੇ ਕਿ ਲੋਕ ਬਹੁਤ ਦੂਰੋਂ ਦੂਰੋਂ ਘੁੰਮਣ ਆਉਂਦੇ ਹਨ ਉੱਥੇ ਆਪਣਾ ਪਹਾੜਾਂ ਨੂੰ ਦੇਖਣ ਠੰਡੀਆਂ ਹਵਾ ਖਾਂਦੇ ਹਨ ਅਤੇ ਬਹੁਤ ਸਾਰੇ ਝਰਨੇ ਦੇਖਣ ਆਉਂਦੇ ਹਨ